ਹੈਲੋ ਹਾਂਜੀ ਅਮਨ ਅਮਨ ਬੋਲ ਰਿਹਾ ਸੀ ਸ਼ਰਮਾ ਬੂਟ ਹਾਊਸ ਬੋਲ ਰਿਹਾ ਜੀ ਹਾਂਜੀ ਸਰ ਬੂਟ ਲੈਣ ਆਉਣਾ ਸੀਗਾ ਜੀ ਆਪਣੇ ਕੋਲ ਹਾਂਜੀ ਕਿਹੜੀ ਕੰਪਨੀ ਮਿਲ ਜਾਣ ਆਪਣੀ ਹੈਗੀ ਬੇਟੇ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਾਂ ਨੂੰ ਚਾਹੀਦੇ ਦੱਸ ਜੋੜੇ ਘੱਟੋ ਘੱਟ ਠੀਕ ਹੈ ਜੀ ਸ਼ੇਰਵਾਨੀ ਨਾਲ ਪਾਉਣ ਵਾਸਤੇ ਜੀ ਠੀਕ ਹੈ ਜੀ ਨਹੀਂ ਜੀ ਨਹੀਂ ਰੇਟ ਦਾ ਕੁਝ ਉਹ ਤਾਂ ਰੀਜਨਲ ਲੈਣੇ ਹੈਗੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਜੀ ਆਪਾਂ ਇੱਕ ਵਧੀਆ ਕੰਮ ਵਧੀਆ ਮਾਲ ਦਿਆਂਗੇ ਇਹਦੇ 'ਤੇ ਇਹ ਨਹੀਂ ਹੈਗਾ ਕਿ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜੇ ਛੋਟੇ ਨਿੱਕੇ ਬੱਚਿਆਂ ਵਾਸਤੇ ਹਾਂਜੀ ਹਾਂਜੀ ਠੀਕ ਹੈ ਦੋ ਬੱਚੇ ਆਪਣੇ ਛੋਟੇ ਹੀ ਨੇਗੇ ਡੇਢ ਕ ਸਾਲ 'ਚ ਇੱਕ ਆਪਣੇ ਦੂਜੇ ਬੱਚਿਆਂ ਵੱਡੇ ਹੋ ਗਏ ਆਪਣੇ ਨਿੱਕੇ ਬੱਚੇ ਉਹਨਾਂ ਵਾਸਤੇ ਜਾਂ ਕੋਈ ਫਲਾਵਰ ਟਾਈਪ ਹੋਗੇ ਜਾਂ ਕੋਈ ਜਿਵੇਂ ਕੋਈ ਛੋਟੇ ਪ੍ਰਫੋਲੀ ਬਣੇ ਹੁੰਦੇ ਆ ਜਾਂ ਕੋਈ ਬੱਚਿਆਂ ਦੀ ਹਾਂਜੀ

ਅਨਿਲ ਗਰੋਸਰੀ ਆਈ ਸੀ ਗਵਾਂਢੀ ਉਹ ਲੈ ਕੇ ਗਏ ਸੀ ਮੈਰਜ ਵਾਸਤੇ ਮੈਨੂੰ ਉਹਨਾਂ ਨੇ ਆਪਣਾ ਸੀ ਇਹ ਨੰਬਰ ਲੈ ਕੇ ਮੈਂ ਕਨਫਰਮ ਕਰ ਲਾਂਗੇ ਜਿਹੜੀ ਆਪਣੀ ਚੀਜ਼ ਚਾਹੀਦੀ ਮਿਲ ਵੀ ਜਾਵੇਗੀ ਅਤੇ ਨਹੀਂ ਇਸ ਕਰਕੇ ਲੈ

ਠੀਕ ਹੈ ਜਿਹੜੇ ਲੈ ਦੇ ਵਿੱਚ ਲਵਾਂਗੇ ਜੀ ਕਲਰ ਕਲਰ ਇੱਕੋ ਹੀ ਹੈ ਕਈ ਪ੍ਰਕਾਰ ਨੂੰ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੋ ਹਾਂਜੀ ਹਾਂਜੀ ਇਹ ਤਾਂ ਹੁਣ ਮੈਰਿਜ ਦੇ ਵਿੱਚ ਵੱਸਦੇ ਹੋ ਗਏ ਬਾਕੀ ਨੋਰਮਲ ਮੰਗਦਾ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਰ ਕੌਣ ਵਧੀਆ ਕੰਮ 'ਤੇ ਓ ਸਰ ਥੈਂਕ ਯੂ ਕੱਲ੍ਹ ਫਿਰ ਤੁਹਾਡੇ ਕੋਲ ਜ਼ਰੂਰ ਆਊਂਗੇ ਅਡਰੈਸ ਦੱਸ ਦਿਓ ਠੀਕ ਹੈ ਜੀ ਠੀਕ ਹੈ ਸਰ ਥੈਂਕ ਯੂ ਜੀ ਪਹਿਲਾਂ ਹਾਂਜੀ ਠੀਕ ਠੀਕ ਹੈ ਜੀ ਕੱਲ੍ਹ ਆਵਾਂਗੇ ਓਕੇ ਜੀ